ਹਾਂਜੀ ਬਿਜਲੀ ਬੋਰਡ ਕਸਟਮਰ ਕੇਅਰ ਤੋਂ ਗੱਲ ਕਰ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰ ਮੇਰਾ ਨਾਮ ਸੁਰਿੰਦਰ ਸਿੰਘ ਹੈ ਅਤੇ ਮੈਂ ਪਿੰਡ ਔਲਖ ਫਰੀਦਕੋਟ ਦਾ ਰਹਿਣ ਵਾਲਾ ਹਾਂ ਗਲੀ ਨੰਬਰ ਪੰਜ ਕੁਝ ਦਿਨ ਪਹਿਲਾਂ ਹੀ ਮੈਂ ਆਪਣਾ ਪਤਾ ਭਾਗ ਸਿੰਘ ਵਾਲਾ ਫਰੀਦਕੋਟ ਵਿਖੇ ਬਦਲੀ ਕਰ ਲਿਆ ਹੈ ਅਤੇ ਘਰ ਸ਼ਿਫਟ ਕਰਦੇ ਸਮੇਂ ਮੇਰੇ ਕੋਲੋਂ ਬਿਜਲੀ ਦੇ ਸਾਰੇ ਬਿਲ ਜੋ ਪੁਰਾਣੇ ਅਦਾਇਗੀ ਵਾਲੇ ਸਨ ਉਹ ਗੁੰਮ ਹੋ ਗਏ ਹਨ ਜੋ ਕਿ ਕਰੀਬ ਦੋ ਕੁ ਸਾਲ ਪੁਰਾਣੇ ਹੋਣਗੇ ਅਤੇ ਮੇਰਾ ਬਿਜਲੀ ਮੀਟਰ ਨੰਬਰ ਇੱਕ ਦੋ ਤਿੰਨ ਚਾਰ ਪੰਜ ਛੇ ਹੈ ਸੋ ਮੈਨੂੰ ਆਪਣਾ ਬਿਜਲੀ ਭੁਗਤਾਨ ਦਾ ਮੇਰਾ ਪੁਰਾਣਾ ਰਿਕਾਰਡ ਜੋ ਵੀ ਹੈ ਉਹ ਕਿਰਪਾ ਕਰਕੇ ਤੁਸੀਂ ਭੇਜਣ ਦੀ ਕਿਰਪਾਲਤਾ ਕਰੋ ਕੀ ਤੁਸੀਂ ਮੈਨੂੰ ਮੇਰਾ ਦੋ ਸਾਲ ਪੁਰਾਣਾ ਬਿਜਲੀ ਬਿੱਲਾਂ ਦੇ ਅਦਾਇਗੀ ਦੀਆਂ ਪ੍ਰਮਾਣਿਤ ਕਾਪੀ ਪ੍ਰਮਾਣਿਤ ਕਾਪੀਆਂ ਮੇਰੇ ਨਵੇਂ ਪਤੇ

ਭਾਗ ਸਿੰਘ ਵਾਲਾ ਗਲੀ ਨੰਬਰ ਅੱਠ ਜ਼ਿਲ੍ਹਾ ਫਰੀਦਕੋਟ 'ਤੇ ਅਤੇ ਮੇਰੀ ਈਮੇਲ ਆਈ ਡੀ ਜੋ ਕਿ ਪਹਿਲਾਂ ਹੀ ਰਜਿਸਟਰ ਕੀਤੀ ਹੋਈ ਹੈ 'ਤੇ ਭੇਜ ਸਕਦੇ ਹੋ ਸਰ ਇਹ ਰਿਕਾਰਡ ਮੇਰੇ ਲਈ ਬਹੁਤ ਹੀ ਜ਼ਰੂਰੀ ਹੈ ਜੋ ਕਿ ਮੈਂ ਸਾਂਭਿਆ ਹੋਇਆ ਸੀ ਉਹ ਤਾਂ ਪਹਿਲਾਂ ਹੀ ਗੁੰਮ ਹੋ ਗਿਆ ਹੈ ਕਿਰਪਾ ਕਰਕੇ ਇਹ ਰਿਕਾਰਡ ਮੈਨੂੰ ਦੁਬਾਰਾ ਭੇਜਣ ਦੀ ਕਿਰਪਾਲਤਾ ਕੀਤੀ ਜਾਵੇ ਅਤੇ ਨਾਲ ਹੀ ਈਮੇਲ ਦੁਆਰਾ ਵੀ ਭੇਜਣ ਦੀ ਕਿਰਪਾਲਤਾ ਕੀਤੀ ਜਾਵੇ ਜੀ ਧੰਨਵਾਦ